ਮੈਨੂੰ ਖਾਣ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਮੱਛੀ ਪਸੰਦ ਨਹੀਂ ਹੈ ਕਿਉਂਕਿ ਮੈਂ ਨੌਨ ਵੈੱਜ ਨਹੀਂ ਖਾਂਦੀ ਪਰ ਹਾਂ ਮੈਨੂੰ ਦਰਬਾਰ ਸਾਹਿਬ ਜਾ ਕੇ ਜਾਂ ਕਿਸੇ ਵੀ ਗੁਰਦੁਆਰੇ 'ਚ ਜਾ ਕੇ ਜੋ ਸਰੋਵਰਾਂ 'ਚ ਮੱਛੀਆਂ ਹੁੰਦੀਆਂ ਹਨ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀਆਂ ਉਹਨਾਂ ਨੂੰ ਦੇਖਣਾ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ